ਭਾਰਤੀ ਸਮਾਜ ਵਿੱਚ ਧਰਮ ਦੀ ਬਹੁਤ ਭੂਮਿਕਾ ਹੈ ਮੈਂ ਭਾਰਤੀ ਧਰਮ ਸਿੱਖ ਧਰਮ ਵਿੱਚ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਹਾਂ ਕਈ ਹੋਰ ਕਈ ਧਰਮ ਹੁੰਦੇ ਹਨ ਜਿਵੇਂ ਮੁਸਲਿਮ ਹਿੰਦੂ ਈਸ ਈਸਾਈ ਮੁ ਹਿੰਦੂ ਆਪਣੇ ਅਸੂਲ ਦੇ ਪੱਕੇ ਹੁੰਦੇ ਹਨ ਮੁਸਲਿਮ ਲੋਕ ਪੰ ਦਿਨ ਵਿੱਚ ਪੰਜ ਵਾਰ ਨਵਾਜ਼ ਪੜ੍ਹਦੇ ਹਨ ਅਤੇ ਆਪਣੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਦੇ ਹਨ ਉਹ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਹਾਂ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੀ ਹਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੀ ਹਾਂ ਅਤੇ ਮੈਂ ਹਰ ਇੱਕ ਧਰਮ ਨੂੰ ਸਤਿਕਾਰ ਦਿੰਦੀ ਹਾਂ ਕਿਸੇ ਵੀ ਧਰਮ ਨੂੰ ਬੁਰਾ ਜਾਂ ਭਲਾ ਨਹੀਂ ਬੋਲਦੀ ਮੈਂ ਮੈਂ ਮੁਸਲਿਮ ਧਰਮ ਮੈਂ ਮੁਸਲਿਮ ਧਰਮ ਵਾਲੇ ਵੀ ਆਪਣੇ ਅਸੂਲ ਦੇ ਪੱਕੇ ਹੁੰਦੇ ਹਨ ਇੱਕ ਨਾ ਇੱਕ ਚੰਗਾ ਨਾਗਰਿਕ ਆਪਣੀ ਦੇਸ਼ ਦੀ ਏਕਤਾ ਨੂੰ ਬਣਾਈ ਰੱਖਣ ਲਈ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ ਉਹ ਆਪਣੇ ਦੇਸ਼ ਦੀ ਏਕਤਾ ਨੂੰ ਬਣਾਈ ਰੱਖਦਾ ਹੈ ਅਤੇ ਕਿਸ ਜੋ ਕੋਈ ਉਸਨੂੰ ਭੜਕਾਉਂਦਾ ਹੈ ਤਾਂ ਉਸ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ ਉਹ ਆਪਣੇ ਦੇਸ਼ ਦੀ ਏਕਤਾ ਨੂੰ ਹਮੇਸ਼ਾ ਹੀ ਬਣਾਈ ਰੱਖਦਾ ਹੈ